ਹੈਲੋ ਨਮਸਕਾਰ ਐਮ ਐਚ ਹੋਸਪਿਟਲ ਜੀ ਮੈਮ ਮੈਂ ਕਿਵੇਂ ਮਦਦ ਕਰ ਸਕਦਾ ਤੁਹਾਡੀ ਜੀ ਮੈਮ

ਮੈਡਮ ਡਾਕਟਰ ਦੀ ਵਿਜੀਟ ਬਿਲਕੁਲ ਵਿੱਚ ਹੀ ਹੁੰਦੀ ਹੈ ਰੂਮ ਰੈਂਟ ਨੇ ਫਿਰ ਵੀ ਮੈਂ ਇੱਕ ਵਾਰੀ ਬਿਲ ਚੈੱਕ ਕਰ ਲੈਦਾ ਮੈਂ ਤੁਹਾਨੂੰ ਫਿਰ ਇਹਦੇ ਬਾਰੇ ਜਾਣਕਾਰੀ ਦਿੰਦਾ ਕਿ ਤੁਸੀਂ ਮੈਨੂੰ ਆਪਣਾ ਰਜਿਸਟਰਡ ਮੋਬਾਇਲ ਨੰਬਰ ਦੱਸੋ ਮੈਮ ਪਲੀਜ਼ ਨਾਇਨ ਟ੍ਰੀਪਲ ਏਟ ਫੌਰ ਵਨ ਫਾਇਵ ਫੌਰ ਟੂ ਨਾਇਨ ਮੈਮ ਪੇਸ਼ਂਟ ਦਾ ਨਾਮ ਮਨੀਸ਼ਾ ਸੀ ਜੀ ਜੀ ਮੈਮ ਮੈਮ ਤੁਸੀਂ ਦਸ ਤਰੀਕ ਨੂੰ ਐਡਮਿਟ ਹੋਏ ਸੀ ਤੇ ਚੌਦਾਂ ਨੂੰ ਡਿਸਚਾਰਜ ਮਿਲਿਆ ਸੀ ਤੁਹਾਨੂੰ ਠੀਕ ਹੈ ਜੀ ਮੈਮ ਜਿਵੇਂ ਕਿ ਮੈਂ ਦੇਖ ਪਾ ਰਿਹਾ ਤੁਹਾਡਾ ਰੂਮ ਦਾ ਰੇਂਟ ਪੰਜ ਹਜ਼ਾਰ ਰੁਪਏ ਲੱਗਾ ਹੋਇਆ ਔਰ ਜਿਹੜੇ ਤੁਸੀਂ ਡਾਕਟਰ ਦੀ ਵਿਜਿਟ ਕਹਿ ਰਹੇ ਹੋ ਉਹ ਮੈਮ ਜਿਹੜੇ ਰੈਗੂਲਰ ਡਾਕਟਰ ਦੀ ਨਹੀਂ ਹੈ ਬਾਹਰੋਂ ਸਪੈਸ਼ਲ ਡਾਕਟਰ ਬੁਲਾਏ ਸੀ ਕਿਉਂਕਿ ਤੁਹਾਡੇ ਪੇਟ ਦੇ ਵਿੱਚ ਦਰਦ ਨੂੰ ਫਰਕ ਨਹੀਂ ਪੈ ਰਿਹਾ ਸੀ ਤੇ ਇਸ ਕਰਕੇ ਬਾਹਰੋਂ ਇੱਕ ਡਾਕਟਰ ਆਏ ਸੀ ਸਪੈਸ਼ਲੀ ਦੇਖਣ ਲਈ ਉਹਨਾਂ ਨੇ ਇੰਡੋਸਕੋਪੀ ਕਰਨੀ ਸੀਗੀ ਤੇ ਉਹਨਾਂ ਦੀ ਚਾਰਜਿਸ ਪਏ ਹੋਏ ਆ ਮੈਮ ਨਾ ਕਿ ਤੁਹਾਡੇ ਰੈਗੂਲਰ ਡਾਕਟਰ ਵੀਜੀਟ ਦੇ ਚਾਰਜ ਪਏ ਆ ਤੇ ਜਿਹੜਾ ਤੁਸੀਂ ਕਹਿ ਰਹੇ ਜੀ ਮੈਮ ਬਿਲਕੁਲ ਜੇ ਤੁਹਾਨੂੰ ਫੌਰਟੀ ਫਾਇਵ ਹਨ੍ਡਰ੍ਡ ਗਏ ਆ ਆਪਾਂ ਬਿਲਕੁਲ ਤੁਹਾਨੂੰ ਰਿਫੰਡ ਮਿਲ ਜਾਏਗਾ ਤੁਸੀਂ ਕੰਮ ਕਰ ਲਓ ਤੁਹਾਡੇ ਕੋਲ ਮੈਂ ਓਰੀਜਨਲ ਬਿੱਲ ਪਿਆ ਹੋਣਾ ਉਹ ਬਿੱਲ ਲੈ ਕੇ ਇੱਕ ਵਾਰੀ ਤੁਸੀਂ ਹੋਸਪਿਟਲ ਵਿਜਿਟ ਕਰ ਲਓ ਤੇ ਰਿਸੈਪਸ਼ਨ ਦੇ ਤੁਸੀਂ ਦਿਖਾ ਦੇਣਾ ਤੁਹਾਨੂੰ ਜਿਹੜੇ ਹੈਗੇ ਆ ਏਕ੍ਸਟ੍ਰਾ ਚਾਰ੍ਜਿਸ ਰਿਫੰਡ ਹੋ ਜਾਣਗੇ